ਹੈਲੋ ਹਾਂਜੀ ਹਾਂਜੀ ਹਾਂਜੀ ਬਨੇਸ਼ ਵਾਲੇ ਬੋਲ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਹਾਂ ਠੀਕ ਆ ਜੀ ਚਾਹ ਕੌਫੀ ਹੋਜੂਗੀ

ਓਹ ਕਰ ਦਾਂਗੇ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਜਾਣਕਾਰੀ ਦੋ ਤਰ੍ਹਾਂ ਦਾ ਕੰਮ ਆ ਜੀ ਜਾਂ ਤਾਂ ਕੰਮ ਤਾਂ ਹੁੰਦਾ ਸਾਡਾ ਇੱਕ ਨੰਬਰ ਜੀ ਤੁਹਾਨੂੰ ਪਤਾ ਹੀ ਆ ਤੁਸੀਂ ਜਿੱਥੇ ਮਰਜ਼ੀ ਪਤਾ ਕਰ ਲਿਓ ਸਾਡਾ ਹਾਂਜੀ ਉਹਦਾ ਕਾਰਨ ਇਹ ਆ ਵੀ ਦੋ ਤਰ੍ਹਾਂ ਦਾ ਵੀ ਜਾਂ ਤਾਂ ਉੱਕੀ ਮੁੱਕੀ ਪਲੇਟ ਹੋਜੂਗੀ ਹਜ਼ਾਰ ਰੁਪਏ ਪਲੇਟ 'ਚ ਤੁਹਾਨੂੰ ਸਾਰਾ ਕੁਛ ਦੇਦਾਂਗੇ ਵਿੱਚੇ ਵੇਟਰ ਦੇ ਦਾਂਗੇ ਵਿੱਚੇ ਸਾਰਾ ਕੁਛ ਜੋ ਤੁਸੀਂ ਸਮਾਨ ਦੱਸਾਂਗੇ ਲਿਸਟ ਬਣਾ ਕੇ ਤੁਹਾਨੂੰ ਬਕਾਇਦਾ ਦਵਾਂਗੇ ਜੀ ਜਾਂ ਫਿਰ ਤੁਸੀਂ ਐਂ ਕਰਿਓ ਜੀ ਸਾਨੂੰ ਰੈਂਟ 'ਤੇ ਰੈਂਟ 'ਤੇ ਲੈ ਲਿਓ ਤੁਸੀਂ ਆਪਣਾ ਸਮਾਨ ਤਿਆਰ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਬੰਦੇ ਸਾਰੇ ਦੇ ਦਾਂਗੇ ਵੇਟਰ ਦੀ ਦਿਹਾੜੀ ਪੰਜ ਸੌ ਰੁਪਈਆ ਚੱਲਦੀ ਆ ਜੀ ਹੁਣ ਅੱਜ ਕੱਲ੍ਹ ਅਤੇ ਬਾਕੀ ਮੇਰੇ ਹਾਂਜੀ ਹਾਂ ਹਾਂ ਵਰਦੀ ਪਾਈ ਵੀ ਹੋਵੇਗੀ ਸਾਫ਼ ਸੁਥਰੇ ਹੋਣਗੇ ਜੀ ਸਾਰੀ ਕੋਈ ਗੱਲ ਨਹੀਂ ਹੈ ਜੀ ਬਸ ਫਿਰ ਠੀਕ ਆ ਜੀ ਤੁਸੀਂ ਪਲੇਟ ਸਿਸਟਮ ਕਰ ਲਿਓ ਫਿਰ ਸਭ ਤੋਂ ਵਧੀਆ ਰਹੇਗਾ ਤੁਹਾਨੂੰ ਸਾਡੀ ਜਿੰਮੇ ਸਾਡੀ ਜ਼ਿੰਮਵਾਰੀ ਆ ਤੁਸੀਂ ਸਾਡੇ ਕੋਲ ਆਓ ਇੱਥੇ ਦੁਕਾਨ 'ਤੇ ਆ ਜਿਓ ਆਪਾਂ ਬੈਠ ਕੇ ਸਾਰੀ ਗੱਲਬਾਤ ਕਰ ਲਾਂਗੇ ਠੀਕ ਆ ਜੀ ਹਾਂਜੀ ਹਾਂਜੀ ਕੱਲ੍ਹ ਆ ਜਿਓ ਸਤਿ ਸ਼੍ਰੀ ਅਕਾਲ ਜੀ